ਡੇਂਗੂ ਬੁਖਾਰ ਅਤੇ ਮਲੇਰੀਆ ਵਰਗੀਆਂ ਜਿਹੜੀਆਂ ਬਿਮਾਰੀਆਂ ਹਨ ਉਹ ਇਹ ਮੱਛਰਾਂ ਤੋਂ ਹੁੰਦੀਆਂ ਨੇ ਡੇਂਗੂ ਇੱਕ ਹਿਸਾਬ ਦੇ ਨਾਲ ਮੱਛਰ ਦੇ ਕੱਟਣ ਤੋਂ ਹੋ ਜਾਂਦਾ ਡੇਂਗੂ ਮੱਛਰ ਜਿਵੇਂ ਸਾਫ ਪਾਣੀ ਦੇ ਵਿੱਚ ਪਨਪਦਾ ਅਤੇ ਮਲੇਰੀਆ ਦੇ ਜੋ ਮੱਛਰ ਨੇ ਉਹ ਗੰਦੇ ਪਾਣੀ ਦੇ ਵਿੱਚ ਪਨਪਦਾ ਅਸੀਂ ਇਨ੍ਹਾਂ ਤੋਂ ਬਚਣ ਵਾਸਤੇ ਸਾਨੂੰ ਆਪਣਾ ਆਲਾ ਦੁਆ ਦੁਆਲਾ ਸਾਫ ਰੱਖਣਾ ਚਾਹੀਦਾ ਜਿਸ ਤਰ੍ਹਾਂ ਕਿ ਕਿਸੇ ਵੀ ਕੂਲਰ ਦੇ ਵਿੱਚ ਪਾਣੀ ਇਕੱਠਾ ਨਹੀਂ ਹੋਣਾ ਚਾਹੀਦਾ ਗਮਲਿਆਂ 'ਚ ਪਾਣੀ ਇਕੱਠਾ ਨਹੀਂ ਹੋਣਾ ਚਾਹੀਦਾ ਦੋ ਦਿਨ ਦਾ ਪਾਣੀ ਕਿਤੇ ਵੀ ਕਿਸੇ ਵੀ ਜਗ੍ਹਾ 'ਤੇ ਇਕੱਠਾ ਨਹੀਂ ਹੋਣਾ ਚਾਹੀਦਾ ਸਾਨੂੰ ਆਪਣਾ ਗਾਰਡਨ ਏਰੀਆ ਸਾਫ ਸੁਥਰਾ ਕਾਫੀ ਹੱਦ ਤੱਕ ਰੱਖਣਾ ਚਾਹੀਦਾ ਖਾਣ ਪੀਣ ਵੇਲੇ ਢੱਕੀਆਂ ਹੋਣੀਆਂ ਚਾਹੀਦੀਆਂ ਚੀਜ਼ਾਂ ਜੋ ਸਾਨੂੰ ਸਫਾਈ ਦੇ ਵਿੱਚ ਬਣਾਉਣੀਆਂ ਚਾਹੀਦੀਆਂ ਘਰ ਦੇ ਵਿੱਚ ਤੁਸੀਂ ਆਪਣਾ ਓਡੋਮੋਸ ਲਗਾ ਸਕਦੇ ਹੋ ਬੱਚਿਆਂ ਨੂੰ ਜਿਵੇਂ ਪਾਰਕ ਭੇਜਦੇ ਹੋ ਉਹਨਾਂ ਨੂੰ ਕਰੀਮ ਜਾਂ ਓਡੋਮੋਸ ਜੋ ਵੀ ਹੁੰਦਾ ਰੂਲਰ ਉਹ ਲਗਾ ਕੇ ਤੁਸੀਂ ਭੇਜੋ ਜਿਹਦੇ ਨਾਲ ਤੁਸੀਂ ਇੰਨਾ ਡੇਂਗੂ ਅਤੇ ਮਲੇਰੀਆ ਤੋਂ ਬਚ ਸਕਦੇ ਹੋ ਧੰਨਵਾਦ